ਮੈਂ ਸ਼ਿਲਪਾ ਮੈਂ ਅਤੇ ਮੇਰੇ ਦੋਸਤ ਨੇ ਇੱਕ ਦਿਨ ਛੁੱਟੀ ਨੂੰ ਘੁੰਮਣ ਦਾ ਪ੍ਰੋਗਰਾਮ ਬਣਾਇਆ ਅਤੇ ਅਸੀਂ ਖਾਣ ਪੀਣ ਲਈ ਸਾਰੇ ਇੱਕ ਦਿਨ ਹੋਟਲ ਵਿੱਚ ਗਏ ਅਸੀਂ ਹੋਟਲ ਵਿੱਚ ਜਾ ਕੇ ਉੱਥੇ ਬੈਠੇ ਮੈਂ ਅਤੇ ਮੇਰੀ ਸਹੇਲੀਆਂ ਬਹੁਤ ਹੀ ਖੁਸ਼ ਸਨ ਆਪਾਂ ਬਹੁਤ ਸਾਰੀਆਂ ਗੱਪਾਂ ਮਾਰੀਆਂ ਪਹਿਲਾਂ ਆਪਾਂ ਪਾਣੀ ਲਈ ਓਡਰ ਕੀਤਾ ਪਹਿਲਾਂ ਤਾਂ ਸਾਨੂੰ ਪਾਣੀ ਹੀ ਉਹਨਾਂ ਨੇ ਬਹੁਤ ਹੀ ਜ਼ਿਆਦਾ ਗਰਮ ਦਿੱਤਾ ਜੋ ਕਿ ਠੰਡਾ ਨਹੀਂ ਸੀ ਫਿਰ ਅਸੀਂ ਵੇਟਰ ਨੂੰ ਮੈਨਿਊ ਚਾਟ ਲਈ ਬੋਲਣ ਨੂੰ ਕਿਹਾ ਉਹ ਮੈਨਿਊ ਚਾਟ ਲੈ ਕੇ ਸਾਡੇ ਕੋਲ ਆਇਆ ਜਦੋਂ ਅਸੀਂ ਮੈਨਿਊ ਚਾਰਟ ਦੇਖਿਆ ਤਾਂ ਅਸੀਂ ਉਸ ਵਿੱਚੋਂ ਖਾਣ ਲਈ ਮਟਰ ਪਨੀਰ ਮਿਕਸ ਸਬਜ਼ੀ ਅਤੇ ਰੋਟੀਆਂ ਮੰਗਵਾਈਆਂ ਅਤੇ ਉਸ ਨਾਲ ਅਸੀਂ ਮਿੱਠੇ ਲਈ ਖਾਣ ਲਈ ਕੁਝ ਮਿੱਠਾ ਓਡਰ ਕੀਤਾ ਜਦੋਂ ਅਸੀਂ ਬੈਠ ਕੇ ਥੋੜ੍ਹੀ ਦੇਰ ਗੱਪਾਂ ਮਾਰੀਆਂ ਇੰਨੇ ਨੂੰ ਸਾਡਾ ਖਾਣਾ ਵੀ ਆ ਗਿਆ ਪਹਿਲਾਂ ਅਸੀਂ ਇੱਕ ਦੂਜੇ ਨੂੰ ਸਰਵ ਕੀਤਾ ਖਾਣਾ ਤਾਂ ਦੇਖਣ ਵਿੱਚ ਬਹੁਤ ਹੀ ਸੁਆਦਿਸ਼ਟ ਲੱਗ ਰਿਹਾ ਸੀ ਅਤੇ ਗਰਮ ਵੀ ਸੀ ਜਦੋਂ ਅਸੀਂ ਮਟਰ ਪਨੀਰ ਖਾਣ ਲੱਗੇ ਤਾਂ ਸਾਨੂੰ ਮਟਰ ਪਨੀਰ ਵਿੱਚੋਂ ਸਮੈਲ ਜਿਹੀ ਆਉਣ ਲੱਗ ਪਈ ਫਿਰ ਜਦੋਂ ਅਸੀਂ ਦੇਖਿਆ ਕਿ ਮਟਰ ਪਨੀਰ ਵਿੱਚੋਂ ਜੋ ਕਿ ਪਨੀਰ ਸੀ ਉਹ ਬਹੁਤ ਹੀ ਜ਼ਿਆਦਾ ਬੁੱਸਿਆ ਹੋਇਆ ਸੀ ਜੋ ਕੀ ਇਹ ਸਭ ਕੁਝ ਵੇਖ ਕੇ ਸਾਡਾ ਮੂਡ ਖ਼ਰਾਬ ਹੋ ਗਿਆ ਫਿਰ ਅਸੀਂ ਹੋਟਲ ਦੇ ਕਿਸੇ ਸਟਾਫ ਨੂੰ ਬੁਲਾਇਆ ਅਤੇ ਉਹਨੂੰ ਸ਼ਿਕਾਇਤ ਕੀਤੀ ਫਿਰ ਵੀ ਸਾਡਾ ਦਿਲ ਨਹੀਂ ਮੰਨਿਆ ਫਿਰ ਅਸੀਂ ਹੋਟਲ ਦੇ ਮੈਨੇਜਰ ਕੋਲ ਗਏ ਹੋਟਲ ਦੇ ਮੈਨੇਜਰ ਨੂੰ ਆਪਾਂ ਬਹੁਤ ਕੁਛ ਬੋਲਿਆ ਇਹ ਖਾਣਾ ਖਾ ਕੇ ਸਾਨੂੰ ਤਬੀਅਤ ਵੀ ਸਾਡੀ ਖ਼ਰਾਬ ਹੋ ਸਕਦੀ ਸੀ ਮੈਨੇਜਰ ਨੇ ਸਾਡੇ ਕੋਲੋਂ ਮਾਫ਼ੀ ਮੰਗੀ ਪਰ ਇਸ ਨਾਲ ਸਾਡਾ ਤਾਂ ਛੁੱਟੀ ਵੀ ਖ਼ਰਾਬ ਹੋ ਚੁੱਕੀ ਸੀ ਅਤੇ ਨਾਲ ਹੀ ਸਾਡਾ ਮੂਡ ਵੀ ਖ਼ਰਾਬ ਹੋ ਗਿਆ ਸੀ ਅਤੇ ਅਸੀਂ ਮੈਨੇਜਰ ਨੂੰ ਕਿਹਾ ਕਿ ਇਹ ਖਾਣਾ ਕਿਸੇ ਵੀ ਨੂੰ ਵੀ ਨਾ ਦੇਣ ਕਿਉਂਕਿ ਇਸ ਨਾਲ ਸਾਡਾ ਪੇਟ ਤਾਂ ਖ਼ਰਾਬ ਹੋ ਚੁੱਕਿਆ ਸੀ ਬਾਕੀਆਂ ਦਾ ਨਾ ਹੋਵੇ ਸਾਡਾ ਇਹ ਐਕਸਪੀਰੀਐਂਸ ਬਹੁਤ ਹੀ ਮਾੜਾ ਸੀ ਹੋਟਲ ਵਿੱਚ ਖਾਣਾ ਖਾਣ ਤੋਂ ਪਹਿਲਾਂ ਸਾਨੂੰ ਇਹ ਵੇਖਣਾ ਚਾਹੀਦਾ ਹੈ ਕਿ ਹੋਟਲ ਵਿੱਚ ਖਾਣਾ ਕਿਸ ਤਰ੍ਹਾਂ ਬਣ ਰਿਹਾ ਹੈ ਸਾਡਾ ਦਿਨ ਦਾ ਸਾਰਾ ਦਿਨ ਮੂ਼ਡ ਖ਼ਰਾਬ ਹੋ ਗਿਆ ਅਤੇ ਅਸੀਂ ਸਾਰੀ ਸਹੇਲੀਆਂ ਆਪਣੇ ਆਪਣੇ ਘਰ ਚਲੇ ਗਏ